ਹਾਂ ਬਹੁਤ ਵਧੀਆ ਜੀ ਹਾਂਜੀ ਕੌਣ ਜੀ ਹਾਂ ਹਾਂ ਬਹੁਤ ਵਧੀਆ ਜੀ ਅੱਛਾ ਜੀ ਅੱਛਾ ਅੱਛਾ ਠੀਕ ਹੈ ਜੀ ਸ਼ਰਮਾ ਟੈਲੀਕੋਮ ਤੋਂ ਬੋਲਦੇ ਜੀ ਦੱਸੋ ਜੀ ਕੀ ਸੇਵਾ ਕਰੀਏ ਹਾਂਜੀ ਹਾਂਜੀ ਅੱਛਾ ਜੀ ਕਿਹੜੀ ਕੰਪਨੀ ਸੈਮਸੰਗ ਦਾ ਜੀ ਅੱਛਾ ਕਿਹੜਾ ਮਾਡਲ ਹੈ ਵੀਰੇ ਅਜੇ ਏ ਸਿਰੀਜ ਵਾਲੇ ਆ ਜੀ ਅੱਛਾ ਅੱਛਾ ਠੀਕ ਹੈ ਜੀ ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜਵਾਕ ਤਾਂ ਨੀ ਯੂਜ ਕਰਦੇ ਤੁਹਾਡਾ ਫੋਨ ਇਹ ਅੱਛਾ ਅੱਛਾ ਠੀਕ ਠੀਕ ਹੈ ਜੀ ਅੱਛਾ ਅੱਛਾ ਕੋਈ ਨੀ ਇੱਕ ਤਾਂ ਤੁਸੀਂ ਮਾਇਕ ਦੀ ਪ੍ਰੌਬਲਮ ਦਸ ਰਹੇ ਹੋ ਨਾ ਜੀ ਅੱਛਾ ਇੱਕ ਜੈਕ ਦੀ ਦੱਸ ਰਹੇ ਓਂ ਉਥੋਂ ਚਾਰਜਰ ਨਹੀਂ ਲੱਗਦਾ ਹੋਣਾ ਨਾ ਸਹੀ ਢੰਗ ਨਾਲ ਅੱਛਾ ਅੱਛਾ ਅੱਛਾ ਜੀ ਠੀਕ ਹੈ ਮਾਇਕ ਦੀ ਤੁਹਾਨੂੰ ਗਾਂਹਾਂ ਵਾਲੇ ਬੰਦੇ ਦੀ ਆਵਾਜ਼ ਸੁਣਦੀ ਹੈ ਕਿ ਤੁਹਾਡੀ ਆਪਣੀ ਨਹੀਂ ਜਾਂਦੀ ਜੀ ਅੱਛਾ ਅੱਛਾ ਤੁਹਾਨੂੰ ਜਿਹੜਾ ਮੂਹਰਲਾ ਬੰਦਾ ਗੱਲ ਕਰਦਾ ਉਹ ਦੀ ਤੁਹਾਨੂੰ ਸੁਣਾਈ ਦੇ ਜਾਂਦੀ ਹੈ ਅੱਛਾ ਅੱਛਾ ਅੱਛਾ ਤੁਹਾਡੇ ਵਾਲੀ ਨਹੀਂ ਅੱਗੇ ਜਾ ਰਹੀ ਅੱਛਾ ਜੀ ਹਾਂਜੀ ਹਾਂਜੀ ਹਾਂ ਨਹੀਂ ਨਹੀਂ ਵਧੀਆ ਕਰ ਦਵਾਂਗੇ ਵੀਰੇ ਤੁਸੀਂ ਨਾ ਆਪਣੇ ਇੱਥੇ ਆਇਓ ਸਾਡੇ ਕੋਲ ਤਾਂ ਆਫ਼ਿਸ ਆ ਜਾਇਓ ਸੈਮਸੰਗ ਦਾ ਆਫਿਸ ਹੈ ਨਾਲ ਹੀ ਆਪਣੀ ਇਹਦੀ ਵਰਕਸ਼ਾਪ ਹੈਗੀ ਸੋਫਟਵੇਅਰ ਦਾ ਸਾਰਾ ਕੰਮ ਹੈ ਆਪਾਂ ਤੁਹਾਨੂੰ ਇਹ ਨਾ ਜਦੋਂ ਤੁਸੀਂ ਹੰਡਾਇਆ ਤੋਂ ਬਰਨਾਲੇ ਨੂੰ ਜਾਓਂਗੇ ਹਾਂ ਕਚਹਿਰੀ ਰੋਡ ਦੇ ਉੱਪਰ ਹੀ ਹੈਗੀ ਸ਼ਰਮਾ ਟੈਲੀਕੋਮ ਲਿਖਿਆ ਹੈਗਾ ਹਾਂ ਬਿਲਕੁਲ ਨਜ਼ਦੀਕ ਹੈ ਜੀ ਬਾਕੀ ਫੋਨ ਨੰਬਰ ਹੈਗਾ ਤੁਹਾਡੇ ਕੋਲ ਅਤੇ ਕਾਲ ਕਰ ਲਿਓ ਹਾਂਜੀ ਹਾਂਜੀ ਤੁਹਾਡੇ ਉੱਥੇ ਬੈਠਿਆਂ ਤੇ ਹੀ ਆਪਾਂ ਚੈੱਕ ਕਰ ਲਵਾਂਗੇ ਵੀ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਹੋਈ ਤਾਂ ਉਹ ਸੈਂਟਰ ਦੇ ਵਿੱਚ ਅੱਗੇ ਭੇਜਣਾ ਪਊਗਾ ਅਤੇ ਸਾਡੇ ਲੈਵਲ ਦੀ ਇੱਥੇ ਹੋਈ ਤਾਂ ਅਸੀਂ ਨਾਲ ਦੀ ਨਾਲ ਕਰ ਦੇਵਾਂਗੇ ਜੀ ਕੋਈ ਚੱਕਰ ਹੀ ਨਹੀਂ ਗਾ ਹਾਂ ਦਸ ਮਿੰਟਾਂ 'ਚ ਕਰ ਦੇਵਾਂਗੇ ਬਾਈ ਤੁਹਾਡੇ ਬੈਠੇ ਬੈਠੇ ਤੋਂ ਹੀ ਹਾਂ ਹਾਂ ਜਦੋਂ ਕੋਈ ਕੰਮ ਕਰਨ ਦੀ ਸਾਡੇ ਸਮਝ 'ਚ ਆ ਗਿਆ ਤਾਂ ਦਸ ਮਿੰਟ 'ਚ ਨਿਬੇੜ ਦੇਵਾਂਗੇ ਜੇ ਕੋਈ ਵੱਡੀ ਪ੍ਰੋਬਲਮ ਹੋਈ ਫੇਰ ਸਾਨੂੰ ਸੈਂਟਰ 'ਚ ਭੇਜਣਾ ਪਊਗਾ ਤਾਂ ਵੀਰੇ ਲੱਗ ਜਾਂਦੇ ਆ ਚਾਰ ਪੰਜ ਦਿਨ ਲੱਗ ਜਾਂਦੇ ਆ ਹਾਂ ਹਾਂ ਚਾਰ ਪੰਜ ਦਿਨ ਤਾਂ ਲੱਗ ਜਾਂਦੇ ਆਰਾਮ ਨਾਲ ਹੁੰ ਹੁੰ ਹੁੰ ਹੁੰ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂ ਨਹੀਂ ਮੈਂ ਤੁਹਾਡੀ ਸਾਰੀ ਪ੍ਰੋਬਲਮ ਹੁਣ ਈ ਸਮਝ ਗਿਆ ਜੀ ਇਹ ਤੁਹਾਡੇ ਬੱਚੇ ਤੋਂ ਡਿੱਗਿਆ ਹੋਊਗਾ ਉਹਦੇ ਨਾਲ ਸਾਰੀਆਂ ਪ੍ਰੋਬਲਮ ਆਈਆਂ ਜੀ ਇਹ ਸਾਡਾ ਹੈਗਾ ਵੱਧ ਤੋਂ ਵੱਧ ਵੀਹ ਪੱਚੀ ਮਿੰਟਾਂ ਦਾ ਕੰਮ ਹੈ ਤੁਸੀਂ ਆਇਓ ਕੱਲ੍ਹ ਨੂੰ ਆਪਣੇ ਇਥੇ ਆ ਜਿਓ ਜੀ ਅਤੇ ਨਾਲ ਦੀ ਨਾਲ ਤੁਹਾਨੂੰ ਕਰਕੇ ਦੇ ਦੇਵਾਂਗੇ ਹਾਂਜੀ ਹਾਂਜੀ ਤੁਹਾਡਾ ਖਰਚਾ ਵੀ ਨਹੀਂ ਬਾਹਲਾ ਕਰਾਉਂਦੇ ਸਰ ਹਾਂ ਹਾਂਜੀ ਤੁਸੀਂ ਅੱਠ ਤੋਂ ਸਵੇਰੇ ਅੱਠ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ ਜਦੋਂ ਮਰਜ਼ੀ ਆ ਜਿਓ ਜੀ ਹਾਂਜੀ ਜੇ ਤੁਸੀਂ ਪੰਜ ਵਜੇ ਤੀਕਰ ਆਓ ਤਾਂ ਓਦੋਂ ਨਾਲ ਦੀ ਨਾਲ ਉਦੋਂ ਸੈਟ ਕਰਕੇ ਦੇ ਦੇਵਾਂਗੇ ਕਈ ਵਾਰੀ ਜਿਹੜੇ ਮੁੰਡੇ ਕੰਮ ਕਰਨ ਵਾਲੇ ਨਾ ਉਹ ਕਈ ਵਾਰ ਚਲੇ ਜਾਂਦੇ ਆ ਸਾਢੇ ਪੰਜ ਤੋਂ ਬਾਅਦ ਤਿਉਹਾਰ ਵਾਲੇ ਦਿਨ ਚੱਲੀ ਜਾਂਦੇ ਨਾ ਹਾਂਜੀ ਹਾਂਜੀ ਕੋਈ ਗਲ ਨਹੀਂ ਤੁਸੀਂ ਆਓ ਜੀ ਜ਼ਰੂਰ ਗੇੜਾ ਮਾਰੋ ਅਤੇ ਕਰ ਦੇਵਾਂਗੇ ਜੀ ਆਪਾਂ ਹਾਂ ਹਾਂ ਠੀਕ ਹੈ ਸਰ ਓਕੇ ਓਕੇ ਓਕੇ